ਹੈਲੋ ਹਾਂਜੀ ਕੌਣ ਬੋਲ ਰਿਹਾ ਹਾਂ ਹਾਂਜੀ ਹਾਂਜੀ ਮੈਂ ਬੇਕਰੀ ਤੋਂ ਹੀ ਬੋਲ ਰਹੀ ਹਾਂ ਤੁਸੀਂ ਦੱਸੋ ਤੁਸੀਂ ਦੱਸੋ ਤੁਹਾਨੂੰ ਕਿੰਨੇ ਵਾਸਤੇ ਚਾਹੀਦਾ ਕਿੰਨੇ ਦਾ ਚਾਹੀਦਾ ਤੁਹਾਡੇ ਘਰ ਕਿੰਨੇ ਬੱਚੇ ਆਉਣੇ ਆ ਕਿਹਦੇ ਵਾਸਤੇ ਚਾਹੀਦਾ ਬਰਡੇ ਆ ਕੋਈ ਐਨੀਵਰਸੀ ਆ ਕਾਹਦੇ ਵਾਸਤੇ ਚਾਹੀਦਾ ਕਿਹਦੀ ਬੱਚੇ ਦੀ ਠੀਕ ਹੈ ਕਿੰਨੇ ਕੁ ਜਾਣੇ ਤੁਸੀਂ ਸੱਦੇ ਹੋਏ ਨੇ ਵੀਹ ਪੱਚੀ ਹੋ ਜਾਣੇ ਠੀਕ ਆ ਤੁਹਾਨੂੰ ਚਾ ਚਾਰ ਪੌਂਡ ਦਾ ਕੇਕ ਬੜਾ ਹੈ ਤੁਹਾਨੂੰ ਅਤੇ ਕਿਹੜਾ ਫਲੇਵਰ ਕਿਹੜਾ ਚਾਹੀਦਾ ਸਾਡੇ ਕੋਲ ਚੋਕਲੇਟ ਫਲੇਵਰ ਆ ਸਾਰਾ ਕੋਕੋਨਟ ਫਲੇਵਰ ਆ ਦੂਸਰਾ ਵੀ ਆ ਕਰੀਮ ਵੀ ਆ ਫਰੂਟ ਵੀ ਆ ਠੀਕ ਆ ਚੋਕਲੇਟ ਫਲੇਵਰ ਤੁਸੀਂ ਮੈਨੂੰ ਨਾਮ ਸੈਂਡ ਕਰ ਸਕਦੇ ਹੋ ਵੱਟਸਐਪ ਕਰ ਦਿਓ ਜੋ ਵੀ ਨਾਮ ਆ ਬੱਚੇ ਦਾ ਹੈ ਨਾ ਅਤੇ ਮੈਮ ਇੱਕ ਪੌਂਡ ਦਾ ਡੇਢ ਸੌ ਰੁਪਇਆ ਲੱਗੇਗਾ ਚਾਰ ਪੌਂਡ ਦਾ ਕੇਕ ਤੁਸੀਂ ਕਹਿ ਰਹੇ ਹੋ ਛੇ ਸੌ ਰੁਪਏ ਦਾ ਕੇਕ ਪਏਗਾ ਤੁਹਾਨੂੰ ਠੀਕ ਹੈ ਇਹ ਥੋੜ੍ਹਾ ਜਿਹਾ ਘੱਟ ਕਰ ਲਈਏ ਥੋੜ੍ਹਾ ਜਿਹਾ ਮੈਮ ਨਹੀਂ ਹੋ ਸਕਦਾ ਅੱਜ ਕੱਲ੍ਹ ਮਹਿੰਗਾਈ ਬਹੁਤ ਆ ਇੰਨੇ ਦਾ ਹੀ ਛੇ ਸੌ ਦਾ ਹੀ ਪਏਗਾ ਜੈਨੂਅਨ ਆ ਸਾਡਾ ਰੇਟ ਨਹੀਂ ਨਹੀਂ ਸਾਡਾ ਰੇਟ ਮੈਮ ਬਾਕੀਆਂ ਦੇ ਨਾਲੋਂ ਵਧੀਆ ਹੈ ਬਾਕੀਆਂ ਨਾਲੋਂ ਠੀਕ ਆ ਸਾਡਾ ਰੇਟ ਪਰ ਚਲੋ ਤੁਸੀਂ ਫਸਟ ਕਸਟਮਰ ਹੋ ਅਤੇ ਇਸ ਵਾਸਤੇ ਤੁਹਾਨੂੰ ਅਸੀਂ ਫਿਫਟੀ ਰੂਪੀਸ ਲੈੱਸ ਕਰ ਦਿੰਦੇ ਹਾਂ ਫਾਈਵ ਫਿਫਟੀ ਪੰਜ ਸੌ ਪੰਜਾਹ ਰੁਪਏ ਤੁਹਾਨੂੰ ਪੇ ਕਰਨੇ ਪੈਣਗੇ ਇਹਦੇ ਵਾਸਤੇ ਐਡਵਾਂਸ ਕੁਛ ਭੇਜ ਰਹੇ ਹੋ ਕੱਲ੍ਹ ਚਾਹੀਦਾ ਹੈ ਕੇਕ ਤੁਸੀਂ ਦੱਸੋ ਤੁਹਾਨੂੰ ਕਿੰਨੇ ਵਜੇ ਚਾਹੀਦਾ ਹੈ ਠੀਕ ਆ ਤੁਸੀਂ ਕਿਸੇ ਨੂੰ ਭੇਜ ਦਿਓਗੇ ਲੈਣ ਵਾਸਤੇ ਚਲੋ ਠੀਕ ਹੈ ਤੁਸੀਂ ਪੇਮੈਂਟ ਵੀ ਕੱਲ੍ਹ ਹੀ ਕਰੋਗੇ ਪੂਰੀ ਚਲੋ ਠੀਕ ਹੈ ਠੀਕ ਹੈ ਓਕੇ ਬਾਏ